ਭੰਗੜਾ ਪੰਜਾਬੀਆਂ ਦੀ ਸ਼ਾਨ ਹੈ ਭੰਗੜਾ ਪੰਜਾਬ ਵਿੱਚ ਆਮ ਤੌਰ 'ਤੇ ਪਾਇਆ ਜਾਂਦਾ ਹੈ ਛੋਟੀ ਵੱਡੀ ਖੁਸ਼ੀ ਹੋਵੇ ਜਾਂ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਫੰਕਸ਼ਨ ਹੋਵੇ ਤਾਂ ਭੰਗੜਾ ਪਾਇਆ ਜਾਂਦਾ ਹੈ ਪੰਜਾਬ ਵਿੱਚ ਅਤੇ ਪੰਜਾਬ ਤੋਂ ਬਾਹਰ ਜਿੱਥੇ ਵੀ ਪੰਜਾਬੀ ਭਰਾ ਵੱਸਦੇ ਹਨ ਉੱਥੇ ਭੰਗੜਾ ਪਾਇਆ ਜਾਂਦਾ ਹੈ ਛੋਟੇ ਵੱਡੇ ਅਤੇ ਹੋਰ ਕਈ ਤਿਉਹਾਰਾਂ 'ਤੇ ਭੰਗੜਾ ਪਾਇਆ ਜਾਂਦਾ ਹੈ ਭੰਗੜਾ ਪੰਜਾਬ ਦੇ ਕਿਸਾਨਾਂ ਦੀਆਂ ਜਦੋਂ ਫਸਲਾਂ ਪੱਕ ਜਾਂਦੀਆਂ ਤਦ ਵੀ ਭੰਗੜਾ ਪਾਇਆ ਜਾਂਦਾ ਹੈ ਉਹਨਾਂ ਦੀ ਖੁਸ਼ੀ ਮਨਾਉਣ ਦੇ ਵਿੱਚ ਭੰਗੜਾ ਪਾਇਆ ਜਾਂਦਾ ਹੈ ਅਤੇ ਭੰਗੜਾ ਸਿਰਫ ਪੰਜਾਬ ਵਿੱਚ ਹੀ ਨਹੀਂ ਪਾਇਆ ਜਾਂਦਾ ਭੰਗੜਾ ਦੇਸ਼ ਵਿਦੇਸ਼ ਵਿੱਚ ਜਿਹੜੇ ਸਾਡੇ ਪੰਜਾਬੀ ਭਰਾ ਵੱਸਦੇ ਨੇ ਉੱਥੇ ਵੀ ਭੰਗੜਾ ਉਹਨਾਂ ਨੇ ਪ੍ਰਚਲਿਤ ਕਰ ਦਿੱਤਾ ਹੈ ਭੰਗੜੇ ਦੇ ਕੁਛ ਮੁੱਖ ਸਟੈੱਪ ਹਨ ਜਿਵੇਂ ਝੂੰਮਰ ਲੁੱਡੀ ਧਮਾਲ ਇੱਦਾਂ ਹੋਰ ਵੀ ਬਹੁਤ ਸਟੈਪ ਨੇ ਅਤੇ ਸਾਡੇ ਪੰਜਾਬੀ ਭਰਾ ਹੋਰ ਲੋਕ ਨਾਚਾਂ ਨੂੰ ਕਰਨ ਨਾਲੋਂ ਭੰਗੜਾ ਕਰਨਾ ਜ਼ਿਆਦਾ ਮਹੱਤਵਪੂਰਨ ਸਮਝਦੇ ਹਨ